ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਮੈਂ ਨਾ ਇੱਕ ਔਡਰ ਕਰਨਾ ਹੈ ਤੁਸੀਂ ਨੋਟ ਕਰੋਗੇ ਹਾਂਜੀ ਮੈਂ ਹੈ ਨਾ ਦੋ ਪਾਸਤਾ ਮੰਗਵਾਉਣਾ ਚਾਹੁੰਦੀ ਹਾਂ ਇੱਕ ਹੈ ਰੈੱਡ ਸੋਸ ਪਾਸਤਾ ਅਤੇ ਇੱਕ ਵਾਈਟ ਸੋਸ ਪਾਸਤਾ ਅਤੇ ਤੁਸੀਂ ਇਹਦੇ ਨਾਲ ਦੋ ਸ਼ੇਕ ਵੀ ਕਰ ਸਕਦੇ ਹੋ ਤੁਹਾਡੇ ਕੋਲ ਕਿਹੜੇ ਕਿਹੜੇ ਸ਼ੇਕ ਹੈਗੇ ਆ ਹਾਂ ਮੈਨੂੰ ਤੁਸੀਂ ਓਰੀਓ ਸ਼ੇਕ ਦੋ ਕਰ ਦੇਣਾ ਹਾਂ ਹਾਂਜੀ ਤੁਸੀਂ ਦੋ ਓਰੀਓ ਸ਼ੇਕ ਕਰ ਦੇਣਾ ਅਤੇ ਮੇਰੀ ਨਾ ਸਵਿਗੀ ਦੀ ਜਿਹੜੀ ਸਾਈਟ ਹੈਗੀ ਆ ਨਾ ਉਹ ਬੰਦ ਹੋ ਚੁੱਕੀ ਹੈ ਇਸ ਲਈ ਮੈਂ ਡਾਇਰੈਕਟ ਤੁਹਾਡੇ ਨਾਲ ਕੋਂਟੈਕਟ ਕਰ ਰਹੀ ਹਾਂ ਹਾਂਜੀ ਇਸ ਲਈ ਮੈਂ ਤੁਹਾਡੇ ਨਾਲ ਡਾਇਰੈਕਟ ਕੋਂਟੈਕਟ ਕਰ ਰਹੀ ਹਾਂ ਕਿਉਂਕਿ ਮੇਰੀ ਸਾਈਟ ਬੰਦ ਹੋ ਚੁੱਕੀ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਜੋ ਡਿਲੀਵਰੀ ਬੋਆਏ ਹੋਵੇਗਾ ਉਹਨ ਉਹਨੂੰ ਸਮਝਾ ਦੇਣਾ ਹਾਂ ਮੈਂ ਤੁਹਾਨੂੰ ਪੂਰੀ ਆਪਣੀ ਡਿਟੇਲ ਜੋ ਹੈ ਜੋ ਸੈਂਡ ਕਰ ਦੇਵਾਂਗੀ ਹਾਂਜੀ ਅਤੇ ਤੁਸੀਂ ਉਹਨੂੰ ਸਮਝਾ ਦੇਣਾ ਕਿ ਇਸ ਜਗ੍ਹਾ 'ਤੇ ਇਹ ਵਾਲਾ ਔਡਰ ਦੇ ਦੇਵਣ ਹਾਂਜੀ ਅਤੇ ਮੈਂ ਤੇ ਨਾ ਔਡਰ ਜੋ ਹੋਵੇ ਉਹ ਗਰਮ ਹੀ ਹੋਵੇ ਠੰਡਾ ਨਾ ਭੇਜ ਦੇਣਾ ਠੀਕ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਜੋ ਮੇਰਾ ਔਡਰ ਹੈ ਉਹ ਪੂਰੇ ਟਾਈਮ 'ਤੇ ਪਹੁੰਚੇ ਹਾਂਜੀ ਅਤੇ ਬਿਲਕੁਲ ਐਗਜੈਕਟ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਜਾਵੇਗੀ ਤਾਂ ਤੁਸੀਂ ਉਸ ਡਿਲੀਵਰੀ ਬੋਆਏ ਨੂੰ ਕਹਿ ਦੇਣਾ ਕਿ ਉਸ ਜਗ੍ਹਾ 'ਤੇ ਆ ਜਾਵੇ ਤਾਂ ਮੈਂ ਬਾਹਰੋਂ ਪਿਕ ਕਰਲਵਾਂਗੀ ਓਕੇ ਧੰਨਵਾਦ